ਸਤਾਈ ਅਗਸਤ ਦੋ ਹਜ਼ਾਰ ਤਿੰਨ ਸੋਲਾਂ ਜਨਵਰੀ ਉੱਨੀ ਸੌ ਤ੍ਰਿਆਸੀ ਗਿਆਰਾਂ ਜਨਵਰੀ ਦੋ ਹਜ਼ਾਰ ਸੱਤ ਸੱਤ ਸਤੰਬਰ ਦੋ ਹਜ਼ਾਰ ਵੀਹ ਤਿੰਨ ਮਾਰਚ ਉੱਨੀ ਸੌ ਸੱਠ